ਦੋ ਲੱਖ ਪੰਜ ਹਜ਼ਾਰ ਛੇ ਸੌ ਨੱਬੇ ਸੱਤ ਲੱਖ ਤੇਰਾਂ ਹਜ਼ਾਰ ਚਾਰ ਸੌ ਪਚਵੰਜਾ ਇੱਕ ਲੱਖ ਤੇਤੀ ਹਜ਼ਾਰ ਚਾਰ ਸੌ ਚਾਲ਼ੀ ਸੱਤ ਲੱਖ ਇਕਵੰਜਾ ਹਜ਼ਾਰ ਸੱਤ ਸੌ ਇਕਵੰਜਾ ਅੱਠ ਲੱਖ ਚੌਵੀ ਹਜ਼ਾਰ ਦੋ ਸੌ